ਮੇਰਾ ਟੀਚਾ ਹੈ ਕਿ ਮੈਂ ਸਿਲਾਈ ਕਢਾਈ ਦਾ ਸੈਂਟਰ ਖੋਲ੍ਹਣਾ ਚਾਹੁੰਦੀ ਹਾਂ ਕਿਉਂਕਿ ਮੈਂ ਗਰੀਬ ਕੁੜੀਆਂ ਦੀ ਮਦਦ ਕਰ ਸਕਾਂ ਕਿਤੇ ਮੈਂ ਆਪਣਾ ਕੰਮ ਵੀ ਵਧਾਉਣਾ ਚਾਹੁੰਦੀ ਹਾਂ ਅਤੇ ਇਹ ਮੇਰਾ ਇਹ ਟੀਚਾ ਏ ਕਿ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਅ ਪਰਵਰਿਸ਼ ਕਰ ਸਕਾਂ